ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਨਾਲ ਕਦੇ ਇੱਦਾਂ ਹੋਵੇਗਾ ਸਾਡੇ ਘਰ ਵਿੱਚ ਪਹਿਲਾਂ ਤਾਂ ਨੌਰਮਲ ਬਰਸਾਤ ਸੀ ਬਟ ਫਿਰ ਕੁਛ ਟਾਈਮ ਬਾਅਦ ਹੀ ਅਸੀਂ ਦੇਖਿਆ ਕਿ ਘਰ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਅਸੀਂ ਤਾਂ ਵੀ ਉਹਨੂੰ ਇਗਨੋਰ ਕੀਤਾ ਕਿ ਚਲੋ ਕੋਈ ਗੱਲ ਨਹੀਂ ਥੋੜ੍ਹਾ ਬਹੁਤ ਪਾਣੀ ਏ ਅਤੇ ਜੇਕਰ ਜ਼ਿਆਦਾ ਬਰਸਾਤ ਹੋ ਵੀ ਜਾਂਦੀ ਹੈ ਤਾਂ ਕਰਕੇ ਪਾਣੀ ਆ ਗਿਆ ਅਤੇ ਉਹ ਚਲਾ ਜਾਵੇਗਾ ਬਟ ਥੋੜ੍ਹੇ ਟਾਈਮ ਬਾਅਦ ਅਸੀਂ ਦੇਖਿਆ ਕਿ ਪਾਣੀ ਬਹੁਤ ਜ਼ਿਆਦਾ ਉੱਪਰ ਆ ਗਿਆ ਹੈ ਅਸੀਂ ਤਾਂ ਜਾਨ ਬਚਾ ਕੇ ਜਿਸ ਤਰ੍ਹਾਂ ਕਿਸ ਤਰ੍ਹਾਂ ਉੱਥੇ ਤੋਂ ਨਿਕਲ ਗਏ ਲੇਕਿਨ ਜਿਹੜਾ ਸਾਡਾ ਸਾਰਾ ਸਮਾਨ ਸੀ ਕੈਸ਼ ਫਰਨੀਚਰ ਆਦਿ ਹੋਰ ਵੀ ਚੀਜ਼ਾਂ ਉਹ ਸਭ ਕੁਛ ਨੀਚੇ ਰਹਿ ਗਿਆ ਪਾਣੀ ਵਿੱਚ ਉਹ ਸਾਰਾ ਕੁਛ ਗਲ ਕੇ ਖ਼ਰਾਬ ਹੋ ਗਿਆ ਅਤੇ ਬਰਸਾਤ ਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਉੱਪਰ ਤੋਂ ਅਸੀਂ ਵੀ ਛੱਤ 'ਤੇ ਬੈਠੇ ਇੰਤਜ਼ਾਰ ਕਰ ਰਹੇ ਸੀ ਕਿ ਕੋਈ ਸਾਨੂੰ ਆ ਕੇ ਉਰੇ ਤੋਂ ਬਚਾ ਕੇ ਹੀ ਲੈ ਜਾਵੇ ਨਾ ਖਾਣ ਨੂੰ ਰੋਟੀ ਨਾ ਪਾਣ ਨੂੰ ਕੱਪੜੇ ਨਾ ਕੋਈ ਹੋਰ ਚੀਜ਼ ਸਭ ਕੁਛ ਨੀਚੇ ਪਾਣੀ ਵਿੱਚ ਗਲ ਚੁੱਕਿਆ ਸੀ ਪੂਰਾ ਫਿਰ ਕਿਸੇ ਨੇ ਆ ਕੇ ਸਾਡੀ ਮਦਦ ਕੀਤੀ ਸਾਨੂੰ ਤਾਂ ਕੱਢ ਲਿਆ ਲੇਕਿਨ ਸਾਡਾ ਘਰ ਸਾਰਾ ਹੀ ਪਾਣੀ ਵਿੱਚ ਡੁੱਬ ਗਿਆ ਆਹ ਹਾਦਸੇ ਨੇ ਮੇਰੀ ਜੀਵਨ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਅੱਜ ਤੱਕ ਪ੍ਰਭਾਵਿਤ ਕੀਤਾ ਹੈ